ਕੰਮ ਤੋਂ ਬਾਅਦ ਕ੍ਰਿਕਟ ਖੇਡਣਾ ਅਤੇ ਕੁਝ ਵੈੱਬ ਸੀਰੀਸਾਂ ਦੇਖਣ ਵਿੱਚ ਮੇਰੀ ਦਿਲਚਸਪੀ ਹੈ ਕਿਉਂਕਿ ਕ੍ਰਿਕਟ ਖੇਡਣ ਨਾਲ਼ ਇੱਕ ਤਾਂ ਮਨਪ੍ਰਚਾਵਾ ਹੋ ਜਾਂਦਾ ਹੈ ਅਤੇ ਦੂਜਾ ਸਿਹਤ ਵਿੱਚ ਵੀ ਨਿਖਾਰ ਆਉਂਦਾ ਰਹਿੰਦਾ ਹੈ ਅਤੇ ਵੈੱਬ ਸੀਰੀਸਾਂ ਵੇਖਣ ਨਾਲ਼ ਮੈਨੂੰ ਬਹੁਤ ਹੀ ਨੌਲੇਜ ਮਿਲਦੀ ਹੈ ਅਤੇ ਦੁਨੀਆਂ ਦੇ ਅਲੱਗ ਅਲੱਗ ਤਰੀਕਿਆਂ ਦਾ ਪਤਾ ਲੱਗਦਾ ਹੈ ਇਸੇ ਕਰਕੇ ਇਹ ਦੋ ਸ਼ੌਂਕ ਹਨ ਜੋ ਕਿ ਮੈਂ ਆਪਣੇ ਵਿਹਲੇ ਟਾਈਮ ਵਿੱਚ ਕਰਦਾ ਹਾਂ